ਹੈਲੋ ਹੈਲੋ ਵਾਟਰ ਸਪਲਾਈ ਦਫਤਰ ਤੋਂ ਗੱਲ ਕਰ ਰਹੇ ਹੋ ਮੈਂ ਅਮਨ ਬੋਲ ਰਿਹਾ ਹਾਂ ਮੈਂ ਮੇਰਾ ਪਾਣੀ ਦਾ ਬਿੱਲ ਆਨਲਾਈਨ ਭਰਿਆ ਸੀ ਅਤੇ ਮੇਰਾ ਆਈਡੀ ਨੰਬਰ ਦੋ ਪੰਜ ਚਾਰ ਤਿੰਨ ਇੱਕ ਛੇ ਹੈ ਅਤੇ ਮੇਰਾ ਹਾਊਸ ਨੰਬਰ ਦੋ ਵਟਾ ਛੱਤੀ ਸੌ ਅੱਠ ਹੈ ਪਰ ਮੇਰਾ ਅਜੇ ਤੱਕ ਬਕਾਇਆ ਬੋਲ ਰਿਹਾ ਹੈ ਕਿਰਪਾ ਕਰਕੇ ਮੇਰਾ ਬਿਲ ਅਪਡੇਟ ਕੀਤਾ ਜਾਵੇ ਤਾਂ ਜੋ ਮੈਨੂੰ ਲੇਟ ਫੀਸ ਨਾ ਲੱਗੇ ਪਰ ਜੇ ਮੈਨੂੰ ਲੇਟ ਫੀਸ ਲੱਗਦੀ ਹੈ ਤਾਂ ਕਿਰਪਾ ਕਰਕੇ ਉਸ ਨੂੰ ਮਾਫ ਕੀਤਾ ਜਾਵੇ ਕਿਉਂਕਿ ਮੈਂ ਸਮੇਂ ਸਿਰ ਇਸ ਨੂੰ ਭਰ ਚੁੱਕਿਆ ਹਾਂ